ਹੈਲੋ

ਹਾਂਜੀ ਤੁਸੀਂ ਕੈਨੇਡਾ ਮਤਲਬ ਕਿਸ ਬੇਸ 'ਤੇ ਜਾਣਾ ਚਾਹੁੰਦੇ ਹੋ ਵਰਕ ਵੀਜ਼ੇ 'ਤੇ ਜਾ ਸਟੱਡੀ ਵੀਜ਼ੇ 'ਤੇ ਹਾਂਜੀ ਅਤੇ ਉਹਦੇ ਲਈ ਕੀ ਕਹਿੰਦੇ ਆ ਪਹਿਲਾਂ ਤੁਹਾਨੂੰ ਸਾਰੇ ਡੋਕੂਮੈਂਟਸ ਆਪਣੇ ਕੰਮਲੀਟ ਕਰਨੇ ਪੈਣਗੇ ਫਿਰ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਆਈਲੈਟਸ 'ਚ ਸਾਢੇ ਛੇ ਬੈਂਡ ਕੰਪਸਲਰੀ ਹੈ ਅੱਜ ਕੱਲ੍ਹ ਦੇਣੇ ਦੁੱਗਣੇ ਪੈਣਗੇ ਪਰ ਡੋਕੂਮੈਂਟ ਵਗੈਰਾ ਉਹ ਕਰਕੇ ਫਿਰ ਤੁਸੀਂ ਕਿਸੇ ਵੀ ਵਧੀਆ ਇੰਸਟੀਟਿਊਟ ਤੋਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਪਹਿਲਾਂ ਤੁਹਾਡੇ ਤਿੰਨ ਮਹੀਨੇ ਉਹਨੂੰ ਲੱਗ ਜਾਣੇ ਆ ਪਾਸਪੋਰਟ ਅਪਲਾਈ 'ਚ ਫਿਰ ਤੁਸੀਂ ਇੰਸਟੀਟਿਊਟ ਬਾਈ ਲੱਖ ਹੈ ਅਪਰੋਕਸ ਲਾ ਕੇ ਜੇ ਆਪਾਂ ਬਾਕੀ ਸਾਰੇ ਖਰਚੇ ਵੀ ਮਿਲਾ ਕੇ ਚੱਲੀਏ ਤਾਂ ਪੱਚੀ ਲੱਖ ਤੱਕ ਅਰਮਾਨ ਨਾਲ ਲੱਗ ਜਾਂਦਾ ਹਾਂਜੀ ਹਾਂ ਹਾਂਜੀ ਵਧੀਆ ਸੈਂਟਰ ਨੇ ਉਹਨਾਂ ਨੇ ਕਾਫੀ ਬੱਚਿਆਂ ਦੇ ਪਹਿਲਾਂ ਵੀ ਵੀਜ਼ੇ ਲਗਵਾਏ ਨੇ ਹਾਂਜੀ ਟ੍ਰੱਸਟਿੰਗ ਹੋਣ ਹਾਂਜੀ ਹਾਂਜੀ ਉਹਨਾਂ ਨੇ ਬਹੁਤ ਵਧੀਆ ਟ੍ਰੇਨਡ ਟੀਚਰ ਰੱਖੇ ਹੋਏ ਨੇ ਤੁਹਾਨੂੰ ਵਧੀਆ ਸਟੱਡੀਜ਼ ਕਰਵਾਉਣਗੇ ਪੂਰਾ ਮਟੀਰੀਅਲ ਪ੍ਰੋਵਾਈਡ ਕਰਨਗੇ